ਮੇਰਾ ਮਨਪਸੰਦੀਦਾ ਟੈਲੀਵਿਜ਼ਨ ਸ਼ੋਅ ਇਸ਼ਕਬਾਜ਼ ਹੈ ਇਹ ਸ਼ੋਅ ਮੈਨੂੰ ਇਸ ਲਈ ਪਸੰਦ ਹੈ ਕਿਉਂਕਿ ਇਸ ਸ਼ੋਅ ਵਿੱਚ ਕੋਮੇਡੀ ਬਹੁਤ ਹੈ ਅਤੇ ਇਸ ਵਿੱਚ ਇੱਕ ਪਰਿਵਾਰ ਦੀ ਅਹਿਮੀਅਤ ਦਰਸਾਈ ਗਈ ਹੈ ਕਿ ਇੱਕ ਪਰਿਵਾਰ ਜੇਕਰ ਹਮੇਸ਼ਾ ਸਾਥ ਰਹੇਗਾ ਤਾਂ ਉਸ ਪਰਿਵਾਰ ਵਿੱਚ ਕਦੇ ਕੋਈ ਝਗੜਾ ਨਹੀਂ ਹੋਵੇਗਾ ਭਾਵ ਕਿ ਸਾਥ ਰਹਿਣ ਦੇ ਨਾਲ ਨਾਲ ਸਾਨੂੰ ਕਿਸੇ ਵੀ ਪਰਿਵਾਰਿਕ ਮੈਂਬਰ ਤੋਂ ਈਰਖਾ ਨਹੀਂ ਕਰਨੀ ਚਾਹੀਦੀ ਇਸ ਸ਼ੋਅ ਵਿੱਚ ਪਰਿਵਾਰ ਦੀ ਅਹਿਮੀਅਤ ਇੱਕ ਦੂਜੇ ਦਾ ਸਾਥ ਦੇਣ ਅਤੇ ਜਾਤ ਪਾਤ ਦੇ ਵਹਿਮ ਤੋਂ ਵੀ ਦੂਰ ਰਹਿਣ ਦੀ ਸਿੱਖਿਆ ਮਿਲਦੀ ਹੈ ਇਸ ਸ਼ੋਅ ਦੇ ਹਰੇਕ ਪਾਰਟ ਵਿੱਚ ਦੁੱਖ ਦੇ ਸਮੇਂ ਵਿੱਚ ਸਾਥ ਦੇਣ ਅਤੇ ਨਾਲ ਹੀ ਨਾਲ ਹਾਸੇ ਹੁੰਦੇ ਹਨ ਜੋ ਕਿ ਬਹੁਤ ਹੀ ਆਨੰਦਦਾਇਕ ਹੁੰਦੇ ਹਨ ਇਸ ਲਈ ਮੈਨੂੰ ਇਹ ਸ਼ੇ ਸ਼ੋਅ ਬਹੁਤ ਪਸੰਦ ਹੈ